ਸਵੇਰੇ ਕਿਸੇ ਨੂੰ ਘੋੜ ਸਵਾਰੀ ਕਰਦੇ ਹੋਏ ਦੇਖਿਆ ਤਾਂ ਮੈਂ ਵੀ ਜੀਅ ਕਰਦਾ ਘੋੜ ਸਵਾਰੀ ਮੈਂ ਵੀ ਕਰਾਂ ਅਤੇ ਮੇਰੇ ਵੀ ਅੰਦਰ ਜੋਸ਼ ਆਇਆ ਉਤਾ ਉਤਸ਼ਾਹ ਪੈਦਾ ਹੋਈ ਕਿ ਘੋੜੇ ਦੀ ਸਵਾਰੀ ਮੈਂ ਵੀ ਕਰਾਂ ਕਿਉਂਕਿ ਮੈਂ ਆਕਰਸ਼ਿਤ ਹੋ ਗਿਆ ਘੋੜੇ ਦੀ ਸਵਾਰੀ ਦੂਜੇ ਨੂੰ ਵੇਖ ਕੇ ਮੈਂ ਵੀ ਕਰਾਂ ਘੋੜੇ ਦੀ ਸਵਾਰੀ ਬਹੁਤ ਵਧੀਆ ਹੁੰਦੀ ਹੈ ਘੋੜ ਸਵਾਰੀ ਮੈਨੂੰ ਬਹੁਤ ਪਸੰਦ ਆਈ ਘੋੜ ਸਵਾਰੀ ਪੁਰਾਣੀਆਂ ਰਿਵਾਜ਼ਾਂ ਸੀਗੀਆਂ ਘੋੜੇ ਦੀ ਸਵਾਰੀ ਕਰਦੇ ਸੀਗੇ ਹੁਣ ਵੀ ਪਸੰਦ ਆਉਂਦੀ ਹੈ ਘੋੜੇ ਦੀ ਸਵਾਰੀ ਕਰੀਏ ਮੈਂ ਕੀ ਘੋੜ ਸਵਾਰੀ ਕਰਕੇ ਨਰੇਸ਼ਨ 'ਚ ਹਿੱਸਾ ਲਊਂਗਾ ਦੌੜ 'ਚ ਅਤੇ ਮੈਨੂੰ ਵੀ ਸਵਾਰੀ ਅੰਦਰੋਂ ਪ੍ਰੇਰਿਤ ਹੋਣਾ ਪਿਆ ਘੋੜੇ ਦੀ ਸਵਾਰੀ ਬਹੁਤ ਮੰਨਦੀ ਹੈ ਘੋੜੇ ਦੀ ਸਵਾਰੀ ਕਰਨੀ ਚਾਹੀਦੀ ਹੈ ਅਸੀਂ ਜੀਅ ਕਰਦਾ ਘੋੜੇ ਵੀ ਸਵਾਰੀ ਕਰਾਂਗੇ ਅਤੇ ਘੋੜੇ ਦੀ ਸਵਾਰੀ ਨਾਲ ਬਹੁਤ ਫਾਇਦਾ ਹੁੰਦਾ ਹੈ ਜੋ ਕਿ ਦੌੜ ਲਵਾ ਕੇ ਅਤੇ ਆਪਦੀ ਜੋ ਵੀ ਇਨਾਮ ਜਿੱਤਿਆ ਜਾਂਦਾ ਹੈ ਦੌੜ ਕਰਵਾ ਕੇ ਕਿਉਂਕਿ ਪੁਰਾਣੀ ਸਵਾਰੀ ਹੈ ਰਾਜਿਆਂ ਮਹਾਰਾਜਿਆਂ ਦੀ ਟਾਈਮ ਦੀ ਸਵਾਰੀ ਹੈ ਉਦੋਂ ਲੋਕ ਬਹੁਤ ਕਰਦੇ ਹੁੰਦੇ ਸੀ ਰਾਜਾ ਮਹਾਰਾਜਾ ਕਰਦੇ ਹੁੰਦੇ ਹੁਣ ਵੀ ਕ ਇੱਛਾ ਖਤਮ ਹੁੰਦੀ ਜਾ ਰਹੀ ਹੈ ਕਿ ਹੁਣ ਵੀ ਘੋੜੇ ਦੀ ਸਵਾਰੀ ਕਰਨੀ ਚਾਹੀਦੀ ਹੈ ਵੈਸੇ ਮੇਰੇ ਅੰਦਰ ਵੀ ਜੋਸ਼ ਜਾਗਿਆ ਹਾਂ ਵੀ ਘੋੜੇ ਦੀ ਸਵਾਰੀ ਕਰਨੀ ਚਾਹੀਦੀ ਹੈ ਕਿਉਂਕਿ ਘੋੜੇ ਦੀ ਸਵਾਰੀ ਬਹੁਤ ਮੈਂ ਵੀ ਕਿਸੇ ਨੂੰ ਬਹੁਤ ਦੇਖਿਆ ਘੋੜੇ ਦੀ ਸਵਾਰੀ ਕਰਦੇ ਨੂੰ ਕਿਉਂਕਿ ਬਹੁਤ ਸੋਹਣਾ ਵੀ ਲੱਗਦਾ ਹੈ ਘੋੜੇ ਦੀ ਸਵਾਰੀ ਕਰਦਾ ਹੈ ਤਾਂ ਮੈਂ ਆਕਰਸ਼ਿਤ ਹੋ ਗਿਆ ਤਾਂ ਇਸ ਲਈ ਮੈਂ ਵੀ ਘੋੜੇ ਦੀ ਸਵਾਰੀ ਕਰਨਾ ਚਾਹੁੰਦਾ ਹਾਂ